ਅੱਜ ਮੈਂ ਤੁਹਾਨੂੰ ਪੰਜਾਬ ਦੇ ਮੁੱਖ ਵਪਾਰਕ ਰੁਝਾਨ ਜਾਂ ਉਹਦੇ ਵਿਕਾਸ ਬਾਰੇ ਕੁਛ ਚੀਜ਼ਾਂ ਦੱਸਣਾ ਚਾਹੁੰਦੀ ਹਾਂ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਵਿੱਚ ਬਹੁਤ ਸਾਰੀ ਡਿਜੀ ਡਿਜੀਟਲਾਈਜੇਸ਼ਨ ਅਤੇ ਵਿਸ਼ਵੀਕਰਨ ਹੋਇਆ ਹੈ ਲੋਕ ਆਪਣਾ ਝੋਨਾ ਜਾਂ ਕਣਕ ਇੱਥੋਂ ਬਾਹਰ ਵੇਚਦੇ ਹਨ ਜਿਹਦੇ ਨਾਲ ਨੈਸ਼ਨਲ ਇਨਕਮ 'ਚ ਬਹੁਤ ਵਾਧਾ ਹੁੰਦਾ ਹੈ ਅਸੀਂ ਇਹ ਵੀ ਜਾਣਦੇ ਹਾਂ ਕਿ ਲੋਕ ਹੁਣ ਕੰਬਾਈਨ ਵਗੈਰਾ ਨਾਲ ਆਪਣਾ ਕੰਮ ਕਰਦੇ ਹਨ ਜਿਹਦੇ ਨਾਲ ਟੈਕਨੋਲੋਜੀ ਕਾਰਨ ਲੋਕਾਂ ਨੂੰ ਬਹੁਤ ਮਦਦ ਮਿਲ ਰਹੀ ਹੈ ਲੋਕ ਟਰੈਕਟਰ ਆਦਿ ਨਾਲ ਬਹੁਤ ਸਾਰਾ ਕੰਮ ਇੱਕ ਦੋ ਦਿਨਾਂ 'ਚ ਹੀ ਕਰ ਲੈਂਦੇ ਹਨ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਪਹਿਲਾਂ ਲੋਕ ਮੈਨੁਅਲੀ ਸਾਰਾ ਕੁਛ ਕਰਦੇ ਸੀ ਜਿਹਦੇ ਨਾਲ ਉਹਨਾਂ ਨੂੰ ਜ਼ਿਆਦਾ ਸਮਾਂ ਲੱਗ ਜਾਂਦਾ ਸੀ ਪਰ ਹੁਣ ਬਹੁਤ ਜਲਦੀ ਸਾਰਾ ਕੰਮ ਹੋ ਜਾਂਦਾ ਹੈ ਇਸ ਕਰਕੇ ਅੱਜ ਕੱਲ੍ਹ ਸਾਡੀ ਕਣਕ ਅਤੇ ਝੋਨੇ ਦੀ ਫ਼ਸਲ ਬਾਹਰ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜਾ ਰਹੀ ਹੈ ਜਿੱਦਾਂ ਕਿ ਸਾਨੂੰ ਪਤਾ ਹੈ ਕਿ ਭਾਰਤ ਦੂਜੇ ਨੰਬਰ 'ਤੇ ਹੈ ਪ੍ਰੋਡਕਸ਼ਨ ਵੀਟ ਦੀ 'ਚ ਅਤੇ ਇਸ ਕਰਕੇ ਲੋਕ ਵੀਟ ਨੂੰ ਬਹੁਤ ਜ਼ਿਆਦਾ ਪ੍ਰੈਫਰ ਕਰਦੇ ਹਨ ਜੋ ਪੰਜਾਬ ਵਿੱਚ ਹੁੰਦੀ ਹੈ ਕਿਉਂਕਿ ਇੱਥੋਂ ਦੀ ਮਿੱਟੀ ਬਹੁਤ ਉਪਜਾਊ ਹੁੰਦੀ ਹੈ ਅਤੇ ਇਸ ਮਿੱਟੀ 'ਚ ਕਣਕ ਬੜੀ ਵਧੀਆ ਹੁੰਦੀ ਹੈ ਲੋਕ ਅੱਜ ਕੱਲ੍ਹ ਫਰਟੀਲਾਈਜ਼ਰਸ ਦਾ ਵੀ ਯੂਜ ਕਰ ਰਹੇ ਹਨ ਜੋ ਕਿ ਜੋ ਕਿ ਕਣਕ ਦੀ ਖੇਤੀ ਨੂੰ ਹੋਰ ਵਧਾਉਂਦਾ ਹੈ ਅਤੇ ਲੋਕ ਅੱਜ ਕੱਲ੍ਹ ਇਰੀਗੇਸ਼ਨ ਮੈਥਡਸ ਨਾਲ ਲੋਕ ਟਿਊਬਵੈੱਲਸ ਵਗੈਰਾ ਦਾ ਯੂਜ ਕਰਦੇ ਹਨ ਜਿਹਦੇ ਨਾਲ ਉਹ ਵਧੀਆ ਉਪਜਾਊ ਹੁੰਦੀ ਹੈ ਕਿ ਸਾਨੂੰ ਬਾਰਿਸ਼ ਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ ਅਤੇ ਅਸੀਂ ਆਪਣਾ ਸਮਾਨ ਆਪਣਾ ਜੋ ਵੀ ਫ਼ਸਲ ਹੁੰਦੀ ਹੈ ਉਹਨੂੰ ਆਪਾਂ ਘਰ ਵੀ ਉਗਾ ਸਕਦੇ ਹਾਂ ਵਧੀਆ ਤਰੀਕੇ ਨਾਲ ਥੈਂਕ ਯੂ